ਜਿਵੇਂ ਕੀ ਪੰਜਾਬ ਵਿੱਚ ਹਰ ਇੱਕ ਧਰਮ ਦੇ ਲੋਕ ਰਹਿੰਦੇ ਹਨ ਸਿੱਖ ਇਸਾਈ ਹਿੰਦੂ ਮੁਸਲਿਮ ਚਾਰੋਂ ਧਰਮਾਂ ਦੇ ਲੋਕ ਰਹਿੰਦੇ ਨੇ ਸਾਰੇ ਆਪਣੇ ਆਪਣੇ ਤਿਉਹਾਰ ਬੜੇ ਖੁਸ਼ੀਆਂ ਨਾਲ ਬੜੇ ਹੀ ਚਾਵਾਂ ਨਾਲ ਮਨਾਉਂਦੇ ਨੇ ਕਿਸੇ ਨੂੰ ਕਿਸੇ ਦੀ ਮੰਦਰ ਗੁਰਦੁਆਰੇ ਵਿੱਚ ਜਾਣ ਦੀ ਕੋਈ ਮਨਾਹੀ ਨਹੀਂ ਹੈ ਕੋਈ ਵੀ ਕਿਤੇ ਵੀ ਆ ਜਾ ਸਕਦਾ ਹੈ ਸਾਰੇ ਇੱਕ ਦੂਜੇ ਨਾਲ ਭਾਈਚਾਰਾ ਭੈਣ ਭਰਾਵਾਂ ਵਾਂਗ ਰਹਿੰਦੇ ਹਨ ਕੋਈ ਕਿਸੇ ਨਾਲ ਇਹ ਨਹੀਂ ਹੈ ਕਿ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਕਿ ਸਿਰਫ਼ ਇਹੀ ਧਰਮ ਦੀ ਪਾਲਣਾ ਕਰਨੀ ਹੈ ਜਾਂ ਸਿਰਫ਼ ਇਹੀ ਚੀ ਇਸੇ ਹੀ ਭਗਵਾਨ ਨੂੰ ਮੰਨਣਾ ਹੈ ਕਿਸੇ ਵੀ ਚੀਜ਼ ਦੀ ਕੋਈ ਮਨਾਹੀ ਨਹੀਂ ਹੈ ਕਿਸੇ ਨੂੰ ਹਰ ਕੋਈ ਆਪਣੇ ਧਰਮ ਦੀ ਪਾਲਣਾ ਕਰ ਸਕਦਾ ਹੈ ਕੋਈ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕਰਦਾ ਸਾਰੇ ਬੜੇ ਹੀ ਪ੍ਰੇਮ ਪਿਆਰ ਨਾਲ ਅਤੇ ਇੱਕ ਦੂਜੇ ਦੇ ਤਿਉਹਾਰਾਂ ਨੂੰ ਮਨਾਉਂਦੇ ਨੇ ਬੜੇ ਚਾਵਾਂ ਨਾਲ ਸਾਰੇ ਹੀ ਇੱਕ ਦੂਜੇ ਦੇ

ਆਉਣ ਜਾਣ ਹਰ ਇੱਕ ਦੇ ਤਿਉਹਾਰ ਵਿੱਚ ਬੜੇ ਹੀ ਹਰ ਇੱਕ ਧਰਮ ਦੇ ਤਿਉਹਾਰ ਬੜੇ ਧੂਮ ਧਾਮ ਨਾਲ ਇੱਥੇ ਮਨਾਏ ਜਾਂਦੇ ਨੇ ਕਿਸੇ ਚੀਜ਼ ਦੀ ਕੋਈ ਮਨਾਹੀ ਨਹੀਂ ਹੈ ਇੱਥੇ ਸਾਰੇ ਹੀ ਬੜੇ ਪ੍ਰੇਮ ਪਿਆਰ ਨਾਲ ਰਹਿੰਦੇ ਨੇ